ਮੈਂ ਯੂਟਿਊਬ ਦੇ ਉੱਤੇ ਟੀ ਜੇ ਫੂਡ ਵਾਲਿਆਂ ਦਾ ਤ ਦੇਖਦੀ ਹਾਂ ਉਹਨਾਂ ਦਾ ਰੈਸਿਪੀ ਮੈਨੂੰ ਬਹੁਤ ਸੋਹਣੀ ਬੜੀ ਵਧੀਆ ਲੱਗਦੀ ਹੈ ਲੰਬੀ ਰੈਸਿਪੀ ਨੂੰ ਵੀ ਬੜੇ ਸ਼ਾਰਟ ਤਰੀਕੇ ਦੇ ਵਿੱਚ ਉਹ ਦੱਸ ਦੇ ਨੇ ਉਹ ਆਂਟੀ ਅੰਕਲ ਨੇ ਮਤਲਬ ਕਿ ਫੇਸਬੁੱਕ 'ਤੇ ਵੀ ਉਹਨਾਂ ਦੀਆਂ ਰੈਸਪੀਆਂ ਬਹੁਤ ਜ਼ਿਆਦਾ ਆਉਂਦੀਆਂ ਨੇ ਸਵੇਰੇ ਦੁਪਹਿਰੇ ਰਾਤੀ ਹਰ ਰੋਜ਼ ਨਵੀਂ ਰੈਸਪੀ ਆਉਂਦੀ ਹੈ ਪਰ ਬਹੁਤ ਹੀ ਵਧੀਆ ਮਸਾਲੇ ਹਰ ਨੀਟ ਐਂਡ ਕਲੀਨ ਹਰ ਚੀਜ਼ ਬੜੀ ਸਾਫ਼ ਸਫ਼ਾਈ ਨਾਲ ਬਣਾਉਣੀ ਦੱਸਦੇ ਨੇ ਮੈਨੂੰ ਬਹੁਤ ਸ਼ੌਂਕ ਹੈ ਉਹਨਾਂ ਦੀ ਕੋਈ ਵੀ ਪੰਜਾਬੀ ਰੈਸਿਪੀ ਪਰੋਂਠੇ ਹੋ ਗਏ ਪੰਜਾਬੀ ਡਿਸ਼ ਕ ਮਤਲਬ ਕਿ ਹਰ ਤਰ੍ਹਾਂ ਦਾ ਮੇਰੇ ਉਸ ਉਹਨਾਂ ਦੀ ਰੈਸਿਪੀ ਦੇ ਅਕੋਰਡਿੰਗ ਮੇਰੀ ਫੈਮਲੀ ਦੇ ਵਿੱਚ ਉਹਨੂੰ ਬਹੁਤ ਪਸੰਦ ਕਰਦੇ ਨੇ ਕੋਈ ਵਿਚ ਚੀਜ਼ਾਂ ਨੂੰ ਮਤਲਬ ਕਿ ਕਿਸ ਤਰ੍ਹਾਂ ਯੂਜ ਕਰਨਾ ਹੈ ਕਿਸ ਤਰਾਂ ਥਰੋ ਕਰਨਾ ਹੈ ਕਿਸ ਤਰਾਂ ਉਹਨੂੰ ਨੀਟ ਐਂਡ ਕਲੀਨ ਕਰਨਾ ਹੈ ਹਰ ਚੀਜ਼ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਦੇ ਨੇ ਇਸ ਕਰਕੇ ਮੈਨੂੰ ਉਹਨਾਂ ਦਾ ਟੀ ਜੇ ਫੂਡ ਵਾਲਿਆਂ ਦਾ ਬਹੁਤ ਹੀ ਜ਼ਿਆਦਾ ਪਸੰਦ ਹੈ ਯੂਟਿਊਬ 'ਤੇ ਵੀ ਉਹਨਾਂ ਦਾ ਮੈਨੂੰ ਇੰਨਾ ਵਧੀਆ ਲੱਗਦਾ ਕਿ ਮੈਂ ਰੋਜ਼ ਬਿਨ ਨਾਗਾ ਉਹਨਾਂ ਦੀ ਸਵੇਰੇ ਮੋਰਨਿੰਗ ਦੇ ਵਿੱਚ ਨਵੀਂ ਰੈਸਿਪੀ ਕੋਈ ਵੀ ਚੀਜ਼ ਹੈ ਬੜੇ ਦਿਲ ਨਾਲ ਦਿਮਾਗ ਨਾਲ ਦੇਖਣੀ ਹੈ ਫਿਰ ਉਹਨੂੰ ਮੈਂ ਟਰਾਈ ਕਰਨਾ ਐਕਸਪੈਰੀਮੈਂਟ ਕਰਕੇ ਦੇਖਣਾ ਕਿ ਮੈਨੂੰ ਅੱਛਾ ਲੱਗਦਾ ਰੋਜ਼ ਇੱਕ ਯੂਟਿਊਬ 'ਤੇ ਨਿਸ਼ਾ ਜੀ ਦਾ ਆਉਂਦਾ ਉਹਨਾਂ ਦਾ ਵੀ ਬਹੁਤ ਵਧੀਆ ਰੈਸਪੀਆ ਹੁੰਦੀਆਂ ਅਚਾਰ ਹੋ ਗਏ ਪਿਕ ਕਈ ਤਰ੍ਹਾਂ ਦੇ ਅਚਾਰ ਬਣਾਉਣੇ ਉਹ ਦੱਸਦੇ ਨੇ ਬੜੇ ਸਿੰਪਲ ਸੋਬਰ ਤਰੀਕੇ ਦੇ ਨਾਲ ਮੈਨੂੰ ਬਹੁਤ ਹੀ ਜਿਆਦਾ ਪਸੰਦ ਨੇ ਇਸ ਕਰਕੇ